ਸਤਿ ਸ਼੍ਰੀ ਅਕਾਲ ਹਾਂਜੀ ਟੀ ਵੀ ਅਤੇ ਔਨਲਾਈਨ ਦੀ ਵਿੱਦਿਅਕ ਸਮੱਗਰੀ ਉਪਲੱਬਧ ਹੋਣਾ ਬਹੁਤ ਹੀ ਜ਼ਰੂਰੀ ਹੈ ਜ਼ਿਆਦਾਤਰ ਤਾਂ ਬੱਚਿਆਂ ਲਈ ਬਹੁਤ ਹੀ ਜ਼ਰੂਰੀ ਹੈ ਵੈਸੇ ਵੀ ਬੱਚੇ ਟੀ ਹੱ ਦੇ ਹੱਥ ਵਿੱਚ ਫੋਨ ਉਪਲੱਬਧ ਰਹਿੰਦਾ ਹੀ ਰਹਿੰਦਾ ਹੈ ਉਪ ਕੋਈ ਵੀ ਕੰਮ ਫੋਨ ਦੇ ਬਿਨਾਂ ਕਰ ਹੀ ਨਹੀਂ ਸਕਦੇ ਅਗਰ ਉਹਨਾਂ ਦਾ ਧਿਆਨ ਕਿਸੇ ਪੜ੍ਹਾਈ ਵੱਲ ਚਲ ਜਾਏ ਉਹਨਾਂ ਵਿੱਚ ਕੋਈ ਸਿੱਖਣ ਵਾਲੀ ਵੀਡੀਓ ਵੱਲ ਧਿਆਨ ਚਲ ਜਾਵੇ ਤਾਂ ਉਹ ਸਿੱਖ ਸਕਦੇ ਹਨ ਇੱਦਾਂ ਵੀ ਉਹਨਾਂ ਨੇ ਆਪਣਾ ਟਾਈਮ ਵੇਸਟ ਕਰਨਾ ਹੀ ਹੁੰਦਾ ਹੈ ਜਿੱਦਾਂ ਕਿ ਮੈਂ ਵੀ ਬਹੁਤ ਸਾਰੀ ਵਿੱਦਿਅਕ ਵਿੱਦਿਅਕ ਚੈਨਲ ਨੂੰ ਦੇਖਦੀ ਹਾਂ ਜਿੱਦਾਂ ਡਿਸਕਵਰੀ ਚੈਨਲ ਉੱਥੇ ਵੀ ਬਹੁਤ ਸਾਰੇ ਹੀ ਇਤਿਹਾਸ ਬਾਰੇ ਪਤਾ ਲੱਗਦਾ ਹੈ ਬਹੁਤ ਕੁਛ ਜਾਨਵਰਾਂ ਬਾਰੇ ਪਤਾ ਲੱਗਦਾ ਹੈ ਹੋਰ ਵੀ ਗੇਟਸ ਮੈਸਟਰ ਜਿੱ ਉਹ 'ਤੇ ਵੀ ਕੋਈ ਵੀ ਚ ਕੁਛ ਵੀ ਸਰਚ ਮਾਰਨ 'ਤੇ ਸਭ ਕੁਛ ਆ ਜਾਂਦਾ ਹੈ ਇਹ ਬਹੁਤ ਹੀ ਜ਼ਰੂਰੀ ਹਨ ਬੱਚਿਆਂ ਨੂੰ ਜੋ ਕਿ ਬੱਚੇ ਸੁਣ ਕੇ ਨਹੀਂ ਸਿੱਖ ਸਕਦੇ ਜਦੋਂ ਉਹ ਵੀਡੀਓ ਦੇਖਣਗੇ ਉਹਨਾਂ ਦੇ ਦਿਮਾਗ ਵਿੱਚ ਇੱਕ ਸਮੱਗਰੀ ਬਣ ਜਾਵੇਗੀ ਜਿਸ ਨਾਲ ਉਸਦੇ ਹੋਰ ਜਾਣਕਾਰੀ ਰਹੇਗੀ ਅਤੇ ਜਾ ਦਿਮਾਗ ਵੀ ਵਧੀਆ ਚੱਲਦਾ ਹੈ ਧੰਨਵਾਦ ਜੀ